ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਨੂੰ ਨਾ ਅੰਮ੍ਰਿਤ ਪਾਲ ਨੇ ਤੁਹਾਡਾ ਨੰਬਰ ਦਿੱਤਾ ਸੀਗਾ ਮੈਂ ਮੈਂ ਨਾ ਐਕਚੁਲੀ ਮੈਂ ਪੰਜਾਬ ਘੁੰਮਣ ਆਉਣਾ ਸੀਗਾ ਅਤੇ ਮੈਨੂੰ ਉਹ ਕਹਿੰਦੇ ਸੀ ਵੀ ਉਹਨਾਂ ਨੂੰ ਵੀ ਅਕੇ ਵੀ ਤੁਹਾਡਾ ਨਾਮ ਲਿਆ ਸੀ ਉਹਨਾਂ ਨੇ ਮਲਕੀਤ ਸਿੰਘ ਉਹਦੇ ਨਾਲ ਗੱਲ ਕਰ ਲਿਓ ਅਤੇ ਵੀ ਅਸੀਂ ਹਾਂ ਅਸੀਂ ਘੁੰਮਣ ਵਾਸਤੇ ਆਉਣਾ ਸੀ ਫੈਮਲੀ ਅਤੇ ਬੱਚਿਆਂ ਨੂੰ ਛੁੱਟੀਆਂ ਸੀ ਨਾ ਹਾਂ ਤਾਂ ਉਹ ਮਤਲਬ ਐਂਂ ਹੀ ਪੁੱਛਣਾ ਸੀ ਵੀ ਇੱਥੇ ਸਰਵਿਸ ਸੁਰਵਿਸ ਵਧੀਆ ਬੱਸਾਂ ਦੀ ਪ੍ਰਾਈਵੇਟ ਸਰਵਿਸ ਵੀ ਹੁੰਦੀ ਹੈ ਕਿ ਗਵਰਨਮੈਂਟ ਸਰਵਿਸ ਹੀ ਚੱਲਦੀ ਅੱਛਾ ਜੀ ਵੀ ਸਾਨੂੰ ਕੋਈ ਮਤਲਬ ਵੀ ਘੁੰਮਣ 'ਚ ਕੋਈ ਦਿੱਕਤ ਤਾਂ ਨਹੀਂ ਆਉਂਦੀ ਕਿਤੇ ਅਸੀਂ ਵੀ ਬਸ ਵੇਟ ਕਰੀ ਜਾਈਏ ਸਰਵਿਸ ਫੁਲ ਵੀ ਮਤਲਬ ਸਰਵਿਸ ਫੁਲ ਆ ਵੀ ਟਾਈਮ ਟੂ ਟਾਈਮ ਚਲਦੀਆਂ ਗੱਡੀਆਂ ਐ ਨਾ ਹੋਵੇ ਨਾ ਵੀ ਅਸੀਂ ਅਸੀਂ ਘੰਟਾ ਘੰਟਾ ਸਾਨੂੰ ਵੇਟ ਕਰਨੀ ਪਿਆ ਕਰੇ ਬੱਸ ਦੀ ਅੱਛਾ ਜੀ ਪੰਜ ਪੰਜ ਮਿੰਟ ਬਾਅਦ ਸਰਵਿਸ ਆ ਅਤੇ ਗਰਮੀ ਗੁਰਮੀ ਸਾਰਾ ਮੌਸਮ ਵਧੀਆ ਓਕੇ ਐਂ ਵੀ ਪਰ ਏ ਸੀ ਹੋਣਗੀਆਂ ਬੱਸਾਂ ਤਾਂ ਅੱਛਾ ਅੱਛਾ ਜੀ ਹੂੰ ਹੂੰ ਮੈਨੂੰ ਅੰਮ੍ਰਿਤਪਾਲ ਨੇ ਕਿਹਾ ਸੀ ਕਹਿੰਦਾ ਬਾਈ ਨਾਲ ਗੱਲ ਕਰ ਲਿਓ ਆਪਣੇ ਨਾਲ ਅਤੇ ਇਹਦੇ ਨਾਲ ਕੋਈ ਨਾ ਪਤਾ ਸਾਰੇ ਨੌਲਜ ਹੂੰ ਠੀਕ ਥੈਂਕ ਠੀਕ ਥੈਂਕ ਯੂ ਸਰ ਥੈਂਕ ਯੂ ਓ ਓਕੇ ਸਰ ਓਕੇ